ਹਾਂ ਮੈਂ ਯੋਗਾ ਦੀ ਕਲਾਸ ਸਕੂਲ ਵਿੱਚ ਸ਼ੁਰੂ ਕੀਤੀ ਸੀ ਸ ਛੇਵੀਂ ਕਲਾਸ ਦੇ ਵਿੱਚ ਯੋਗਾ ਦੇ ਇੱਕ ਟੀਚਰ ਆਉਂਦੇ ਸੀਗੇ ਜਿਹੜੇ ਸਾਨੂੰ ਯੋਗਾ ਸਿਖਾਉਂਦੇ ਸੀਗੇ ਅਤੇ ਉਹ ਸਾਨੂੰ ਯੋਗਾ ਦੀ ਕਲਾਸਾਂ ਲਵਾਉਂਦੇ ਸੀਗੇ ਅਤੇ ਅਲੱਗ ਅਲੱਗ ਆਸਨ ਕਰਵਾਉਂਦੇ ਸੀਗੇ ਅਤੇ ਸਾਨੂੰ ਜਿਵੇਂ ਕਿ ਦੋ ਤਿੰਨ ਆਸਨ ਮੈਨੂੰ ਪਤਾ ਜਿਵੇਂ ਪਦਮ ਆਸਨ ਤਾੜ ਆਸਨ ਸੂਰਿਆ ਨਮਸਕਾਰ ਆਦੀ ਇਹਨਾਂ ਦਾ ਮੈਨੂੰ ਪਤਾ ਆ ਅਤੇ ਆਸ ਯੋਗਾ ਕਰਨ ਨਾਲ ਸਰੀਰ ਦੇ ਵਿੱਚ ਲਚਕ ਬਣੀ ਰਹਿੰਦੀ ਹੈ ਚੁਸਤੀ ਫੁਰਤੀ ਰਹਿੰਦੀ ਹੈ ਯੋਗਾ ਕਰਨ ਨਾਲ ਸਾਡੇ ਸਰੀਰ ਦੇ ਸਾਰੇ ਅੰਗ ਅਤੇ ਛੇਤਰ ਖੁੱਲ੍ਹ ਜਾਂਦੇ ਹਨ ਯੋਗਾ ਦਿਵਸ ਵੀ ਮਨਾਇਆ ਜਾਂਦਾ ਹੈ ਭਾਰਤ ਦੇ ਵਿੱਚ ਯੋਗਾ ਦਿਵਸ ਮਨਾਇਆ ਜਾਂਦਾ ਹੈ ਇੱਕੀ ਜੂਨ ਦੋ ਹਜ਼ਾਰ ਇੱਕੀ ਜੂਨ ਨੂੰ ਮਨਾਇਆ ਜਾਂਦਾ ਹੈ ਯੋਗਾ ਯੋਗਾ ਕਰਨ ਨਾਲ ਸਾਡੇ ਸਰੀਰ ਦੀ ਮਾਸਪੇਸ਼ੀਆਂ ਖੁੱਲ੍ਹਦੀਆਂ ਹਨ ਯੋਗਾ ਕਰਨ ਨਾਲ ਸਾਡੇ ਸਰੀਰ ਦੇ ਵਿੱਚ ਲਚਕ ਬਣੀ ਰਹਿੰਦੀ ਹੈ ਯੋਗਾ ਕਰਨ ਦੇ ਨਾਲ ਮੋਟਾਪਾ ਘੱਟ ਹੁੰਦਾ ਹੈ ਯੋਗਾ ਕਰਨ ਨਾਲ ਬਹੁਤ ਸਰੀਰ ਨੂੰ ਫਾਇਦੇ ਹੁੰਦੇ ਹਨ ਕੋਈ ਨੁਕਸਾਨ ਨਹੀਂ ਹੁੰਦਾ ਜੋ ਯੋ ਤਾੜ ਅਸਨ ਵਗੈਰਾ ਕਰਨ ਦੇ ਨਾਲ ਸਰੀਰ ਦੀ ਹਾਈਟ ਵਧਣ ਦੇ ਵਿੱਚ ਬਹੁਤ ਬਹੁਤ ਯੋਗਦਾਨ ਮਿਲਦਾ ਹੈ ਯੋਗਾ ਕਰਨ ਦੇ ਨਾਲ ਸਾਡੇ ਸੁ ਸੁਬਹ ਸਵੇਰੇ ਸਵੇਰ ਦੇ ਟਾਈਮ ਯੋਗਾ ਕਰਨ ਦੇ ਨਾਲ ਸਾਡਾ ਦਿਮਾਗ